ਭਾਰਤ ਦੀ ਜਨਸੰਖਿਆ ਬਹੁਤ ਜ਼ਿਆਦਾ ਵਾ ਜਨਸੰਖਿਆ ਜ਼ਿਆਦਾ ਹੋਣ ਦੇ ਨਾਲ ਜਿਹੜੀ ਆਵਾਜਾਈ ਹੈ ਇਹ ਵੀ ਪ੍ਰਭਾਵਿਤ ਆਪਣੇ ਆਪ ਹੀ ਹੁੰਦੀ ਆ ਜਨਸੰਖਿਆ ਦੇ ਨਾਲ ਨਾਲ ਆਵਾਜਾਈ ਦੇ ਸਾਧਨ ਵੀ ਜ਼ਿਆਦਾ ਵੱਧ ਗਏ ਆ ਲੋਕ ਮੋਟਰ ਜਦੋਂ ਵੀ ਘਰ ਤੋਂ ਜਾਂ ਕਿਤੇ ਵੀ ਘੁੰਮਣ ਫਿਰਨ ਜਾਂ ਆਪਣੇ ਹੋਰ ਕਿਸੇ ਕੰਮ ਲਈ ਜਾਂਦੇ ਆ ਤਾਂ ਉਹ ਆਪਣੀਆਂ ਗੱਡੀਆਂ ਮੋਟਰਾਂ 'ਤੇ ਜਾਂਦੇ ਆ ਸ਼ਹਿਰਾਂ ਦੇ ਵਿੱਚ ਆਟੋ ਵੱਡੀਆਂ ਗੱਡੀਆਂ ਸਕੂਟਰ ਬਸ ਆ ਹੈ ਆਦਿ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਡੀਆਂ ਵਾ ਇਹਦੇ ਨਾਲ ਇੱਕ ਤਾਂ ਕੀ ਹੁੰਦਾ ਕਿ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਵਾ ਜ਼ਿਆਦਾ ਜਾਮ ਲੱਗਣ ਦੇ ਕਾਰਨ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ 'ਚ ਵੀ ਬੜੀ ਮੁਸੀਬਤ ਆਉਂਦੀ ਆ ਜਦੋਂ ਆਪਾਂ ਯਾਤਰਾ 'ਤੇ ਜਾਂਦੇ ਹਾਂ ਅਤੇ ਟ੍ਰੈਫਿਕ ਜਾਮ ਲੱਗੇ ਹੋਣ ਦਾ ਕਾਰਨ ਪਹੁੰਚਣ 'ਚ ਵੀ ਦੇਰੀ ਹੁੰਦੀ ਆ ਟ੍ਰੈਫਿਕ ਪੁਲਿਸ ਜਿਹੜੀ ਆ ਉਹ ਥਾਂ ਥਾਂ 'ਤੇ ਹੋਣੀ ਚਾਹੀਦੀ ਆ ਥਾਂ ਥਾਂ 'ਤੇ ਇਹਨਾਂ ਦੀਆਂ ਚੌਕੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਤਾਂ ਜੋ ਪੁਲਿਸ ਦੇ ਡਰ ਨਾਲ ਲੋਕ ਆਪਣੀ ਆਪਣੀ ਜਗ੍ਹਾ 'ਤੇ ਗੱਡੀ ਖੜ੍ਹੀ ਕਰਕੇ ਜਾਣਗੇ ਅਤੇ ਜਾਣ 'ਚ ਵੀ ਨਿਕਲਣਾ ਵੀ ਉਹਨਾਂ ਨੂੰ ਸੌਖਾ ਹੋਊਗਾ ਜਦੋਂ ਆਪਾਂ ਕਿਤੇ ਨਾ ਕਿਤੇ ਜਾਂਦੇ ਹਾਂ ਅਤੇ ਆਪਾਂ ਰਸਤੇ ਵਿੱਚ ਆਮ ਹੀ ਵੇਖਦੇ ਹਾਂ ਕਿ ਧਰਨੇ ਲੱਗੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਕਿ ਕਿਸਾਨਾਂ ਦੀਆਂ ਆਪਣੀਆਂ ਕੁਝ ਨਾ ਕੁਝ ਮੰਗਾਂ ਹੁੰਦੀਆਂ ਵਾ ਜਿਹਦੇ ਕਰਕੇ ਉਹਨਾਂ ਨੇ ਵੱਡੇ ਵੱਡੇ ਹਾਈਵੇ 'ਤੇ ਆਪਣੇ ਧਰਨੇ ਲਗਾ ਕੇ ਬੈਠੇ ਹੁੰਦੇ ਆ ਅਤੇ ਇਹਦੇ ਨਾਲ ਵੀ ਕੀ ਆ ਸਾਨੂੰ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਜੇ ਦੇ ਜਾਣ ਦੇ ਲਈ ਜਿਹੜੀਆਂ ਸੜਕਾਂ ਵਾ ਉਹ ਚੌੜੀਆਂ ਹੋਣੀਆਂ ਚਾਹੀਦੀਆਂ ਵਾ ਇੱਕ ਜਗ੍ਹਾ ਤੋਂ ਦੂਜੀ ਜਾਣ 'ਤੇ ਜਗ੍ਹਾ 'ਤੇ ਜਾਣ ਲਈ ਜਿਹੜੀਆਂ ਜਾਣ ਦਾ ਰਸਤਾ ਵੱਖ ਹੋਣਾ ਚਾਹੀਦਾ ਗੱਡੀਆਂ ਦੇ ਆਉਣ ਦਾ ਰਸਤਾ ਜਿਹੜਾ ਉਹ ਵੱਖ ਹੋਣਾ ਚਾਹੀਦਾ ਵਾ ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਵਾ ਉਹ ਰਸ਼ ਘਟੇਗਾ ਅਤੇ ਲੋਕ ਸੌਖੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਗੇ